ਹਾਂ ਅਸੀਂ ਕ ਅਸੀਂ ਲੋਕਾਂ ਦੇ ਇੱਕ ਵੱਡੇ ਸਮੂਹ ਲਈ ਖਾਣਾ ਬਣਾਇਆ ਹੈ ਜਿਵੇਂ ਕਿ ਮੈਂ ਮੈਂ ਜਿਵੇਂ ਸਾਡੇ ਘਰ ਦੇ ਲਾਗੇ ਗੁਰਦੁਆਰਾ ਹੈਗਾ ਆ ਉੱਥੇ ਆਪਾਂ ਜਾ ਕੇ ਸੇਵਾ ਕਰਦੇ ਹਾਂ ਜਦੋਂ ਵੀ ਕੋਈ ਗੁਰਪੁਰਬ ਹੁੰਦਾ ਜਾਂ ਤਿਉਹਾਰ ਹੁੰਦਾ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਹਨ ਅਤੇ ਸੇਵਾ ਕਰਦੇ ਹਨ ਮੈਂ ਵੀ ਉਸ ਸੇਵਾ ਦੇ ਵਿੱਚ ਹਾਜ਼ਰ ਹੁੰਦੀ ਹਾਂ ਅਤੇ ਉੱਥੇ ਅਹ ਜਿਵੇਂ ਕਿ ਰੋਟੀ ਦੀ ਸੇਵਾ ਕੀਤੀ ਜਾਂਦੀ ਹੈ ਸਬਜ਼ੀ ਦੀ ਸੇਵਾ ਕੀਤੀ ਜਾਂਦੀ ਹੈ ਗੰਡੇ ਵਗੈਰਾ ਛਿੱਲਣ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਮੈਂ ਪੂਰਾ ਉਹਨਾਂ ਦਾ ਯੋਗਦਾਨ ਦਿੰਦੀ ਹਾਂ ਇਹ ਸਾਰੇ ਸੇਵਾ ਮੈਂ ਵੱਡੇ ਸਮੂਹ ਵਿੱਚ ਲਈ ਹੀ ਕਰਦੀ ਹਾਂ ਅਹ ਇੱਕ ਤਾਂ ਸਾਡਾ ਬਹੁਤ ਹੀ ਵੱਡਾ ਇੱਕ ਹਿਸਾਬ ਦਾ ਉਪਕਾਰ ਹੋ ਜਾਂਦਾ ਹੈ ਅਗਰ ਆਪਾਂ ਪੂਰੇ ਵੱਡੇ ਸਮੂਹ ਲਈ ਖਾਣਾ ਬਣਾਉਂਦੇ ਹਾਂ ਸੇਵਾ ਕਰਦੇ ਹਾਂ ਅਤੇ ਇੱਕ ਤਾਂ ਸਾਡੇ ਦਿਲ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਕਿ ਉਹ ਸਾਰੇ ਲੋਕਾਂ ਲਈ ਆਪਾਂ ਖਾਣਾ ਬਣਾ ਰਹੇ ਹਾਂ ਅਤੇ ਉਹ ਸਾਨੂੰ ਕੀ ਅੱਗੋਂ ਸਾਨੂੰ ਦੁਆਵਾਂ ਦੇਣਗੇ ਜ਼ਰੂਰੀ ਨਹੀਂ ਹੁੰਦਾ ਕਿ ਬਸ ਖਾਣਾ ਬਣਾਉਣਾ ਹੀ ਸਾਡਾ ਇੱਕ ਤਰ੍ਹਾਂ ਦਾ ਇੱਕ ਕੰਮ ਹੁੰਦਾ ਖਾਣਾ ਬਣਾਉਣ ਟਾਈਮ ਸਾਨੂੰ ਦੂਜਿਆਂ ਦੀ ਖੁਸ਼ੀ ਵੀ ਦੇਖਣੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਕਿਉਂਕਿ ਅਗਰ ਆਪਾਂ ਖਾਣਾ ਇਸ ਤਰੀਕੇ ਨਾਲ ਬਣਾਵਾਂਗੇ ਜੋ ਦੂਜਿਆਂ ਨੂੰ ਪਸੰਦ ਹੀ ਨਾ ਆਵੇ ਤਾਂ ਫਿਰ ਸਾਡਾ ਖਾਣਾ ਬਣਾਉਣ ਦਾ ਕੋਈ ਵੀ ਲਾਭ ਹੀ ਨਹੀਂ ਹੈ ਇਸ ਕਰਕੇ ਸਾਨੂੰ ਅਗਰ ਆਪਾਂ ਅਹ ਕਿਹਦੇ ਲੀਏ ਵੀ ਖਾਣਾ ਬਣਾਇਆ ਵੱਡੇ ਸਮੂਹ ਲਈ ਵੀ ਅਗਰ ਆਪਾਂ ਖਾਣਾ ਬਣਾਉਂਦੇ ਹਾਂ ਤਾਂ ਸਾਨੂੰ ਖੁਸ਼ੀ ਪ੍ਰੇਮ ਦੇ ਨਾਲ ਬਣਾਉਣਾ ਚਾਹੁ ਚਾਹੀਦਾ ਹੈ ਅਤੇ ਵੱਡੇ ਸਮੂਹ ਦੇ ਵਿੱਚ ਅਗਰ ਆਪਾਂ ਸਾਰੇ ਇਕੱਠੇ ਮਿਲ ਕੇ ਖਾਣਾ ਬਣਾਉਂਦੇ ਹਾਂ ਇੱਕ ਤਾਂ ਸਾਡੇ ਵਿੱਚ ਪਿਆਰ ਜ਼ਿਆਦਾ ਵੱਧਦਾ ਹੈ ਹੈ ਆਪਾਂ ਨਵੀਆਂ ਨਵੀਆਂ ਚੀਜ਼ਾਂ ਵੀ ਸਿੱਖਦੇ ਹਾਂ ਜਦੋਂ ਆਪਾਂ ਪੂਰੇ ਵੱਡੇ ਸਮੂਹ ਲਈ ਖਾਣਾ ਬਣਾਉਂਦੇ ਹਾਂ ਸਾਨੂੰ ਬਹੁਤ ਸਾਰੀ ਚੀਜ਼ਾਂ ਸਿੱਖਣ ਨੂੰ ਵੀ ਮਿਲਦੀਆਂ ਹਨ ਅਤੇ ਇਹ ਸਭ ਕਰਨਾ ਬਹੁਤ ਵਧੀਆ ਲੱਗਦਾ